ਹਾਂਜੀ ਸਰ ਐਕਚੁਲੀ ਅਸੀਂ ਨਾ ਕੈਬ ਬੁੱਕ ਕੀਤੀ ਸੀਗੀ ਕਾਫੀ ਟਾਈਮ ਹੋ ਗਿਆ ਦਸ ਪੰਦਰਾਂ ਮਿੰਨਟ ਅਤੇ ਤੁਸੀਂ ਆਏ ਨਹੀਂ ਅਜੇ ਤੱਕ ਮੈਂ ਵੇਟ ਕਰ ਰਹੀ ਸੀ ਤੁਹਾਡੀ ਨਾ ਐਕਚੁਲੀ ਮੈਂ ਸਕੂਲ ਜਾਣਾ ਹੁੰਦਾ ਮੇਰੇ ਸਕੂਲ ਦੀ ਟਾਈਮਿੰਗ ਜੋ ਹੈ ਤੁਹਾਨੂੰ ਪਤਾ ਹੀ ਹੈ ਪੂਰੇ ਟਾਈਮ 'ਤੇ ਪਹੁੰਚਣਾ ਹੁੰਦਾ ਤੁਸੀਂ ਅਜੇ ਤੱਕ ਤੁਹਾਡਾ ਕੁਛ ਅਤਾ ਪਤਾ ਹੀ ਨਹੀਂ ਕਿੱਥੇ ਰਹਿ ਗਏ ਆ ਤੁਸੀਂ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਆਉਣ 'ਚ ਜਾਂ ਤੁਹਾਨੂੰ ਸਮਝ ਨਹੀਂ ਲੱਗ ਰਿਹਾ ਤੁਸੀਂ ਪਲੀਜ਼ ਮੈਨੂੰ ਦੱਸੋ ਮੈਂ ਤੁਹਾਨੂੰ ਪੂਰਾ ਰਸਤਾ ਦੱਸ ਦਾਗੀ ਕਿੱਧਰੋਂ ਆਉਣਾ ਜਾਂ ਅਗਰ ਕੋਈ ਇਨ ਕੇਸ ਕੁਛ ਹੈਗਾ ਉੱਥੇ ਕੋਈ ਪ੍ਰੋਬਲਮ ਹੈ ਕੋਈ ਐਕਸੀਡੈਂਟ ਹੋਇਆ ਜਾਂ ਕੁਛ ਵੀ ਹੋਇਆ ਮੈਨੂੰ ਦੱਸੋ ਅਤੇ ਬਾਕੀ ਤੁਸੀਂ ਪਹਿਲਾਂ ਆਪਣਾ ਮੈਨੂੰ ਐ ਜਾਂ ਸਕਰੀਨ ਸ਼ੋਟ ਭੇਜ ਦਿਉ ਤੁਸੀਂ ਕਿੱਥੇ ਹੋ ਜਾਂ ਕਿ ਕਿਹੜੇ ਏਰੀਏ 'ਚ ਹੋ ਗੂਗਲ ਮੈਪ ਲਗਾ ਲਉ ਹੈ ਨਾ ਕਿਉਂਕੀ ਐਕਚੁਲੀ ਜੋ ਵੀ ਸਾਡਾ ਰਸਤਾ ਹੈ ਨਾ ਸਕੂਲ ਦਾ ਉੱਥੇ ਲਾਈਟਸ ਪੈਂਦੀਆਂ ਨੇ ਪੰਜ ਲਾਈਟਸ ਹੈ ਅਤੇ ਫਿਰ ਉੱਥੇ ਵੀ ਬਹੁਤ ਟਾਈਮ ਲੱਗ ਜਾਣਾ ਸਾਨੂੰ ਜਾਣ 'ਚ ਮੈਂ ਬਹੁਤ ਲੇਟ ਹੋ ਜਾਵਾਂਗੀ ਹੈ ਨਾ ਤੁਸੀਂ ਮੈਨੂੰ ਫਾਈਨਲ ਦੱਸੋ ਤੁਸੀਂ ਆ ਰਹੇ ਹੋ ਜਾਂ ਨਹੀਂ ਨਹੀਂ ਤਾਂ ਫਿਰ ਮੈਂ ਜੋ ਆਪਣੀ ਕੈਬ ਹੈ ਮੈਂ ਕੈਂਸਲ ਕਰਕੇ ਕਿਸੇ ਹੋਰ ਨੂੰ ਬੁੱਕ ਕਰਾਂ ਠੀਕ ਹੈ ਮੈਨੂੰ ਦੱਸੋ ਜੀ ਪਲੀਜ਼ ਜਲਦੀ ਠੀਕ ਹੈ ਜੀ